ਖਾਣਾ ਪਕਾਉਣ ਵਾਲੇ ਬਰਤਨ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਐਲੂਮੀਨੀਅਮ ਤਾਂਬਾ ਪਿੱਤਲ ਆਦਿ ਹੁੰਦੇ ਹਨ ਸਭ ਤੋਂ ਵਧੀਆ ਪਿੱਤਲ ਦੇ ਬਰਤਨ ਹੁੰਦੇ ਹਨ ਅਤੇ ਅਸੀਂ ਖਾਣਾ ਪਕਾਉਣ ਵੇਲੇ ਪਿੱਤਲ ਦੇ ਬਰਤਣ ਹੀ ਵਰਤਦੇ ਹਾਂ ਅਤੇ ਜੋ ਕੱਟੜੀ ਹੁੰਦੀ ਹੈ ਉਹ ਵੀ ਅਸੀਂ ਪਿੱਤਲ ਦੀ ਹੀ ਵਰਤਦੇ ਹਾਂ ਇਹ ਪ ਇਹ ਪਿੱਤਲ ਤੋਂ ਅੱਧੀਆਂ ਜੋ ਹਮ ਸਾਨੂੰ ਬਿਮਾਰੀਆਂ ਲੱਗੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਦੂਰ ਕਰਦਾ ਹੈ ਅਤੇ ਸਭ ਤੋਂ ਵਧੀਆ ਹੁੰਦੇ ਹਨ ਇਹਨਾਂ ਵਿੱਚ ਕੋਈ ਮਿਲਾਵਟ ਨਹੀਂ ਪਾਈ ਜਾਂਦੀ ਇਹ ਵਧੀਆ ਪਿੱਤਲ ਦੇ ਹੁੰਦੇ ਹਨ ਜਦੋਂ ਅਸੀਂ ਖਾਣਾ ਖਾਂਦੇ ਹਾਂ ਅਸੀਂ ਉਦੋਂ ਵੀ ਬਰਤਨ ਪਿੱਤਲ ਦੇ ਹੀ ਲੈਂਦੇ ਹਾਂ ਕਿਉਂਕਿ ਪਿੱਤਲ ਸਾਨੂੰ ਬਹੁਤ ਹੀ ਵਧੀਆ ਸਾਡੇ ਸਰੀਰ ਲਈ ਹੁੰਦੀ ਹੈ ਪਿੱਤਲ ਸਾਨੂੰ ਬਹੁਤ ਹੀ ਵਧੀਆ ਫਾਇਦੇਮੰਦ ਹੈ